ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਸੁਖਵਿੰਦਰ ਬੋਲ ਰਿਹਾ ਜੀ ਹਾਂਜੀ ਸਰ

ਸਰ ਸਭ ਤੋਂ ਪਹਿਲੇ ਤਾਂ ਤੁਹਾਨੂੰ ਮੁਬਾਰਕਾਂ ਜੀ ਤੁਸੀਂ ਪਲੱਸ ਟੂ ਕੀਤੀ ਹੈ ਕੋਂਗ੍ਰੈਚੂਲੇਸ਼ਨਸ ਅਤੇ ਉਸ ਤੋਂ ਬਾਅਦ ਦੂਜੀ ਗੱਲ ਉਸ ਤੋਂ ਬਾਅਦ ਸਰ ਇਸ ਤਰ੍ਹਾਂ ਹੈ ਕਿ ਪੜ੍ਹਾਈ ਇੱਕ ਇੱਦਾਂ ਦੀ ਚੀਜ਼ ਹੈ ਕਿ ਜਿਹਨੂੰ ਤੁਸੀਂ ਸਭ ਤੋਂ ਵੱਡਾ ਖਜ਼ਾਨਾ ਮੈਂ ਕਹੂੰਗਾ ਜਿਹਨੂੰ ਕੋਈ ਵੀ ਬੰਦਾ ਚੋਰੀ ਨਹੀਂ ਕਰ ਸਕਦਾ ਇਹ ਤੁਹਾਡੇ ਨਾਲ ਰਹੇਗੀ ਫੋਰਐਵਰ ਨਾ ਟਿੱਲ ਦਾ ਯੂ ਨੋਅ ਲਾਸਟ ਬ੍ਰੈੱਥ ਔਫ ਯੂਅਰ ਲਾਈਫ ਅਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਸਰ ਜਿਹੜਾ ਟੀਚਿੰਗ ਪ੍ਰੋਫੈਸ਼ਨ ਹੈ ਇਹਦੇ ਵਿੱਚ ਤੁਸੀਂ ਜੀ ਬੜੀਆਂ ਲਾਈਕ ਟੀਚਿੰਗ ਜੋਬ ਤੋਂ ਲੈ ਕੇ ਤੁਸੀਂ ਹਾਇਰ ਸਟੱਡੀਜ਼ ਕਰਕੇ ਤੁਸੀਂ ਪ੍ਰੋਫੈਸਰ ਦੀ ਡਿਗਰੀ ਪ੍ਰੋਫੈਸਰ ਤੱਕ ਮਤਲਬ ਅੱਗੇ ਜਾ ਸਕਦੇ ਹੋ ਤਾਂ ਇੱਕ ਵਾਈਟ ਕੋਲਰ ਜੋਬ ਹੈ ਬੜੀ ਅੱਛੀ ਜੋਬ ਹੈ ਅਤੇ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਸਰ ਕਿ ਤੁਸੀਂ ਆਪਣੀ ਜਿਹੜੀ ਗ੍ਰੈਜੂਏਸ਼ਨ ਦੇ ਨਾਲ ਨਾਲ ਸਕਿੱਲਸ ਐਜੂਕੇਸ਼ਨ ਨਾਲ ਲੈ ਕੇ ਅਤੇ ਆਪਣਾ ਕਰੀਅਰ ਹੋਰ ਜ਼ਿਆਦਾ ਅੱਛਾ ਮਤਲਬ ਜਿੱਦਾਂ ਹੁਣ ਸਕਿੱਲ ਐਜੂਕੇਸ਼ਨ ਵਿੱਚ ਦੇਖੋ ਸਰ ਜਿੱਦਾਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਹੈ ਇੱਕ ਸਕਿੱਲ ਹੈ ਤੁਸੀਂ ਕੋਈ ਆਈ ਟੀ ਆਈ ਦੇ ਵਿੱਚ ਕੁਛ ਕੋਰਸਸ ਲੈਂਦੇ ਹੋ ਤੁਹਾਡੀਆਂ ਸਕਿੱਲਸ ਹੈ ਸੋ ਇੱਦਾਂ ਦੀਆਂ ਬੜੀਆਂ ਸਕਿੱਲਸ ਹੈ ਜਿਹੜੀਆਂ ਤੁਹਾਨੂੰ ਫਰਦਰ ਫਿਊਚਰ ਵਿੱਚ ਮਤਲਬ ਦੇਖੋ ਸਰ ਜਿੱਥੇ ਸਕਿੱਲ ਆ ਉੱਥੇ ਬੰਦਾ ਹੰਡਰਡ ਪਰਸੈਂਟ ਸਕਸੈੱਸਫੁਲ ਹੈ ਤੋ ਮੈਨੂੰ ਲੱਗਦਾ ਕਿ ਤੁਸੀਂ ਸਕਿੱਲ ਬੇਸ ਸਬਜੈਕਟ ਲੈ ਕੇ ਅਤੇ ਆਪਣਾ ਅੱਗੇ ਕਰੀਅਰ ਅੱਛਾ ਬਣਾ ਸਕਦੇ ਸਰ ਠੀਕ ਹੈ ਸਰ ਰਾਈਟ ਸਰ ਰਾਈਟ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ